ਸਤਿ ਸ਼੍ਰੀ ਅਕਾਲ ਜੈ ਕੀ ਹਾਲ ਹੈ ਤੇਰੇ ਮੈਂ ਸੁਣਿਆ ਤੂੰ ਆਪਣੇ ਦੋਸਤਾਂ ਨਾਲ ਮਨਜੀਤ ਢਾਬੇ 'ਤੇ ਗਿਆ ਸੀ ਪਿਛਲੇ ਹਫ਼ਤੇ ਪਾਰਟੀ ਕਰਨ ਮੈਂ ਔਰ ਮੈਂ ਸੁਣਿਆ ਹੈ ਉਸ 'ਤੇ ਬਹੁਤ ਵਧੀਆ ਭੋਜਨ ਮਿਲਦਾ ਹੈ ਮੈਨੂੰ ਦੱਸੀਂ ਤੇਰੇ ਵਿਚਾਰ ਕਿੱਦਾਂ ਦੇ ਹੈ ਕਿਉਂਕਿ ਮੈਂ ਵੀ ਅਗਲੇ ਹਫ਼ਤੇ ਆਪਣੇ ਜਨਮ ਦਿਨ ਦੀ ਪਾਰਟੀ ਆਪਣੇ ਦੋਸਤਾਂ ਮਿੱਤਰਾਂ ਨਾਲ ਕਰਨੀ ਹੈ ਉੱਥੇ ਜਾ ਕੇ ਮੈਂ ਚਾਹੁੰਦਾ ਹਾਂ ਕਿ ਉੱਥੇ ਵੈੱਜ ਸਮਾਨ ਮਿਲੇ ਜਿੱਦਾਂ ਕਿ ਸ਼ਾਹੀ ਪਨੀਰ ਰੋਟੀ ਤੰਦੂਰੀ ਹੋਵੇ ਅਤੇ ਦਾਲ ਫਰਾਈ ਹੋਵੇ ਮੈਨੂੰ ਦੱਸੀਂ ਉੱ ਉੱਥੇ ਕਿੱਦਾਂ ਦੀ ਰੇਟਿੰਗ ਚੱਲਦੀ ਹੈ ਔਨਲਾਇਨ ਵੀ ਮੈਂ ਚੈੱਕ ਕੀਤਾ ਸੀ ਬਟ ਉੱਥੇ ਚਾਰ ਪੁਆਇੰਟ ਪੰਜ ਰੇਟਿੰਗ ਚੱਲਦੀ ਹੈ ਅਤੇ ਮੈਨੂ ਮੈਂ ਸੁਣਿਆ ਸੀ ਕਿ ਉੱਥੇ ਕੇਕ ਵੀ ਕੱਟ ਕਰਵਾਉਂਦੇ ਹੈ ਔਨਰ ਆਪਣੇ ਆਪ ਉੱਥੇ ਆ ਕੇ ਪਾਰਟੀ ਵਿੱਚ ਸ਼ਾਮਿਲ ਹੁੰਦਾ ਹੈ ਸਤਿ ਸ਼੍ਰੀ ਅਕਾਲ